ਹੈਲੋ ਸਰ ਹਰਦੀਪ ਸਿੰਘ ਬੋਲਦੇ ਹੋ ਮੈਂ ਪ੍ਰਭਦੀਪ ਮਾਨਾਂਵਾਲਾ ਤੋਂ ਬੋਲਦਾ ਹਾਂ ਸਰ ਮੈਂ ਕੁਝ ਦਿਨ ਪਹਿਲਾਂ ਹੀ ਤੁਹਾਡੇ ਕੋਲ ਕੈਬ ਬੁੱਕ ਕੀਤੀ ਸੀ ਅਸੀਂ ਲੁਧਿਆਣੇ ਜਾਣਾ ਸੀ ਅਜੇ ਸ ਅ ਅਜੇ ਤੁਹਾਡੇ ਦਸ ਵਜੇ ਪਹੁੰਚਣੀ ਸੀ ਤੁਹਾਡੀ ਕੈਬ ਹਜੇ ਤੱਕ ਨਹੀਂ ਸਾਡੇ ਕੋਲ ਆਈ ਸਰ ਜੇ ਨਹੀਂ ਤੁਸੀਂ ਕੈਬ ਭੇਜਣੀ ਤਾਂ ਵੀ ਦੱਸ ਦਿਓ ਜੇ ਨਹੀਂ ਕੈਬ ਆਉਣੀ ਤਾਂ ਅਸੀਂ ਕੋਈ ਹੋਰ ਕੈਬ ਲੈ ਕੇ ਲੁਧਿਆਣੇ ਚਲੇ ਜਾਵਾਂਗੇ ਅਤੇ ਸਾਡੀ ਬੁਕਿੰਗ ਅਤੇ ਪੈਸਾ ਵਾਪਿਸ ਕਰ ਦੇ ਦਿਓ